ਆਪਾਂ ਨੇ ਜੀ ਤੁਹਾਡੀ ਉਹ ਤੋਂ ਬੱਲਬ ਔਰਡਰ ਕਰਿਆ ਸੀ ਸਾਈਟ ਤੋਂ ਉਹਦੇ 'ਚ ਨਾ ਜਿਹੜੇ ਤੁਸੀਂ ਬੱਲਬ ਲਿਖੇ ਸੀ ਨਾਲ ਐੱਲ ਏ ਡੀਆਂ ਉਹਨਾਂ ਦਾ ਚੀਜ਼ਾਂ ਦਾ ਤੁਸੀਂ ਲਿਖਿਆ ਕੁਛ ਸੀ ਨਿਕਲੀ ਚੀਜ਼ ਕੁਛ ਆ ਅਤੇ ਐੱਲ ਏ ਡੀ ਆਪਾਂ ਨੇ ਕਲਰ ਔਡਰ ਕੀਤਾ ਸੀ ਮੈਂਗੋ ਵਾਈਟ ਨਿਕਲਿਆ ਤੁਸੀਂ ਵਾਰਮ ਵਾਈਟ ਅਤੇ ਆਪਣਾ ਬੱਲਬ ਐੱਲ ਈ ਡੀ ਔਰਡਰ ਕੀਤੇ ਸੀ ਉਹ ਵੀਹ ਵਾਟ ਦੇ ਔਰਡਰ ਕੀਤੇ ਸੀ ਨਿਕਲੇ ਨੌ ਵਾਟ ਦੇ ਹੈ ਉਹ ਜਿਹੜੇ ਨੌ ਵਾਟ ਦੇ ਚਾਰ ਕੀਤੇ ਸੀ ਉਹਨਾਂ ਦੇ ਚੱਲੇ ਦੋ ਹੈ ਜਿਹੜੀਆਂ ਐੱਲ ਈ ਡੀਆਂ ਕ ਕੀਤੀਆਂ ਸੀ ਔਡਰ ਉਹਨਾਂ 'ਚ ਤਾਂ ਚੱਲੀ ਓ ਇੱਕ ਹੈ ਬਾਕੀ ਦਾ ਅਸੀਂ ਕਿਆ ਕਰੂੰਗੇ ਨਾਲੇ ਜਿਹੜੀ ਐੱਲ ਈ ਡੀਆਂ ਔਰਡਰ ਕੀਤੀਆਂ ਸੀ ਤੁਸੀਂ ਅਸੀਂ ਕਰੀਆਂ ਤੀਆਂ ਏ ਸੀ ਕਰੰਟ ਵਾਲੀਆਂ ਤੁਸੀਂ ਭੇਜਤੀਆਂ ਡੀ ਸੀ ਕਰੰਟ ਵਾਲੀਆਂ ਹੁਣ ਦੱਸੋ ਅਸੀਂ ਬੈਟਰੀ ਡਾਊਨ ਸੀਲਿੰਗ 'ਚ ਕਿੱਥੋਂ ਲਾਈਏ ਲੈ ਕੇ ਲਾਈਏ ਹੈਂ ਦੱਸੋ ਕੀ ਕਰੀਏ ਇਹ ਇੱਦਾਂ ਮਤਲਬ ਵੀ ਤੁਸੀਂ ਤਾਂ ਸਾਡੇ ਲਾਈਟ ਸਾੜਨੇ ਵਾਲਾ ਕੰਮ ਕਰ ਦੇਣਾ ਤਾ